ਪੰਜ ਜੁਲਾਈ ਦੋ ਹਜ਼ਾਰ ਪੰਜ ਨੌ ਅਗਸਤ ਉੱਨੀ ਸੌ ਨੱਬੇ ਬਾਰ੍ਹਾਂ ਅਪ੍ਰੈਲ ਉੱਨੀ ਸੌ ਇਕਾਹਠ ਵੀਹ ਦਸੰਬਰ ਦੋ ਹਜ਼ਾਰ ਅਠਾਰ੍ਹਾਂ ਉੱਨੀ ਜਨਵਰੀ ਦੋ ਹਜ਼ਾਰ ਇੱਕ